ਪੰਜਾਬੀ ਭਾਸ਼ਾ ਪੰਜਾਬ ਦਾ ਬਹੁਤ ਅੱਛਾ ਵਧੀਆ ਪੰਜਾਬ ਦੇ ਖੇਤਰਾਂ ਦੇ ਵਿੱਚ ਬੋਲੀ ਜਾਣ ਵਾਲੀ ਬੋਲੀ ਹੈ ਕਿਉਂਕਿ ਇਹ ਪੰਜਾਬ ਦੇ ਹਰੇਕ ਆਪਣਾ ਜ਼ਿਲ੍ਹੇ ਅੰਦਰ ਬੋਲੀ ਜਾਂਦੀ ਹੈ ਅਤੇ ਇਹ ਜਿਹੜੀ ਪੰਜਾਬੀ ਭਾਸ਼ਾ ਹੈ ਇਹ ਸਾਡੇ ਬਚਪਨ ਤੋਂ ਦਾਦੇ ਪੜਦਾਦਿਆਂ ਤੋਂ ਚਲਦੀ ਆ ਰਹੀ ਹੈ ਕਿਉਂਕਿ ਜਦੋਂ ਅਸੀਂ ਵੀ ਛੋਟੇ ਸੀ ਅਸੀਂ ਵੀ ਆਪਣੇ ਦਾਦੇ ਤੋਂ ਪੰਜਾਬੀ ਬੋਲਣੀ ਹੀ ਪਹਿਲਾਂ ਸਿੱਖੀ ਸੀ ਕਿਉਂਕਿ ਇਹ ਭਾਸ਼ਾ ਸਾਡੀ ਮਾਂ ਬੋਲੀ ਹੈ ਇਸ ਹੀ ਭਾਸ਼ਾ ਨਾਲ ਸਾਡੀਆਂ ਪੀੜ੍ਹੀਆਂ ਹੀ ਆਪਣੇ ਜੁੜੀਆਂ ਹੋਈਆਂ ਹਨ ਕਿਉਂਕਿ ਇਹ ਸਾਨੂੰ ਵਿਰਾਸਤ ਵਿੱਚ ਮਿਲੀ ਹੈ ਅਤੇ ਇਸ ਅੱਛਾ ਵੀ ਭਾਸ਼ਾ ਦੇ ਨਾਲ ਹੀ ਅਸੀਂ ਜੰਮੇ ਹਾਂ ਵੱਡੇ ਹੋਏ ਹਾਂ ਕਿ ਇਹ ਭਾਸ਼ਾ ਐਸੀ ਵੀ ਭਾਸ਼ਾ ਹੈ ਜੋ ਕਿ ਸਾਡੀ ਜਬਾਨ 'ਤੇ ਹਰ ਦਮ ਰਹਿੰਦੀ ਹੈ ਅਤੇ ਇਹ ਸਾਡੀ ਮਾਂ ਬੋਲੀ ਹੈ ਅਤੇ ਪੰਜਾਬੀ ਭਾਸ਼ਾ ਪੰਜਾਬ ਦੇ ਖੇਤਰ ਦੇ ਆਪਣਾ ਵਿੱਚ ਥਾਂ ਥਾਂ 'ਤੇ ਉਹਨੇ ਮੱਲਾਂ ਮਾਰੀਆਂ ਹਨ ਅਤੇ ਜੋ ਕਿ ਇਹ ਬੋਲਣ ਵਿੱਚ ਵੀ ਸਰਲ ਹੈ ਅਤੇ ਅੱਛਾ ਦੂਜੇ ਬੰਦੇ ਨੂੰ ਵੀ ਸਾਨੂੰ ਪੰਜਾਬੀ ਭਾਸ਼ਾ ਵਿੱਚ ਗੱਲ ਕਰਨੀ ਵੀ ਆਸਾਨ ਹੈ ਅਤੇ ਉਸ ਦੀ ਜਿਹੜੀ ਪੰਜਾਬੀ ਭਾਸ਼ਾ ਹੈ ਉਹ ਸਾਡੇ ਲਈ ਸਮਝਣ ਵਿੱਚ ਵੀ ਆਸਾਨ ਹੈ ਅਤੇ ਸਾਡੇ ਲਈ ਜੋ ਸਾਨੂੰ ਬਚਪਨ ਵਿੱਚ ਜਾਣੀ ਕਿ ਬੋਲੀ ਜਾਂਦੀ ਹੈ ਜੋ ਸਾਨੂੰ ਬਚਪਨ ਵਿੱਚ ਜਾਂ ਵਿਰਾਸਤ ਵਿੱਚ ਅੱਛਾ ਮਿ ਮਿਲੀ ਹੈ ਉਹ ਸਾਡੇ ਲਈ ਇੱਕ ਮਾਂ ਹੈ ਜੇ ਅਸੀਂ ਪੰਜਾਬੀ ਭਾਸ਼ਾ ਨਾਲ ਬਹੁਤ ਪਿਆਰ ਕਰਦੇ ਹਾਂ ਪੰਜਾਬੀ ਭਾਸ਼ਾ ਦਾ ਬਹੁਤ ਆਪਣਾ ਸਤਿਕਾਰ ਆਪਣਾ ਕਰਦੇ ਹਾਂ ਸਾਡੇ ਲਈ ਇੱਕ ਕੁਦਰਤ ਦੀ ਵਡਮੁੱਲੀ ਆਪਣਾ ਦਾਤ ਹੈ